ਮੈਂ ਆਪਣੇ ਬਾਗ ਵਿੱਚ ਬਹੁਤ ਤਰ੍ਹਾਂ ਦੇ ਪੌਦੇ ਲਗਾਏ ਹੋਣ ਹੋਏ ਹਨ ਜਿਵੇਂ ਕਿ ਫੁੱਲਾਂ ਦੇ ਗੁਲਾਬ ਦੇ ਫੁੱਲ ਅਤੇ ਗੇਂਦੇ ਦੇ ਫੁੱਲ ਅਤੇ ਹੋਰ ਵੀ ਬਹੁਤ ਸਾਰੇ ਫੁੱਲਾਂ ਦੇ ਪੌਦੇ ਲਗਾਏ ਹੋਏ ਜਿਵੇਂ ਕਿ ਦੁਪਹਿਰ ਖਿੜੀ ਜਦੋਂ ਇਹ ਫੁੱਲ ਫੁੱਲਾਂ ਦੇ ਪੌਦੇ ਖਿੜਦੇ ਖਿੜਦੇ ਹਨ ਜਾਂ ਇਹਨਾਂ ਉੱਤੇ ਫੁੱਲ ਖਿੜਦੇ ਹਨ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਮੈਂ ਇਹਨਾਂ ਨੂੰ ਸਵੇਰੇ ਸਵੇਰੇ ਉੱਠ ਕੇ ਦੇਖਦੀ ਹਾਂ ਤਾਂ ਇਹਨਾਂ ਉੱਤੇ ਖਿੜੇ ਹੋਏ ਫੁੱਲ ਮਨ ਨੂੰ ਬਹੁਤ ਹੀ ਪ੍ਰਭਾਵਿਤ ਕਰਦੇ ਹਨ ਅਤੇ ਇਹਨਾਂ ਫੁੱਲਾਂ ਨੂੰ ਦੇਖ ਕੇ ਹੀ ਮੇਰਾ ਦਿਨ ਚੜ੍ਹਦਾ ਹੈ ਅਤੇ ਮੈਂ ਇੰਝ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਇਹਨਾਂ ਫੁੱਲਾਂ ਵਾਂਗ ਹੀ ਖਿੜ ਜਾਵਾਂ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਆਸ ਇੱਕ ਨਵੀਂ ਆਸ਼ਾ ਦੇ ਕੇ ਮੈਂ ਆਪਣੀ ਜ਼ਿੰਦਗੀ ਦੀ ਸ਼ੁ ਜ਼ਿੰਦਗੀ ਦੀ ਸਵੇਰ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂਆਤ ਕਰਦੀ ਹਾਂ ਅਤੇ ਇਹਨਾਂ ਅਤੇ ਮੈਂ ਇਹ ਆਸ ਕਰਦੀ ਹਾਂ ਕਿ ਜਿਵੇਂ ਇਹ ਫੁੱਲ ਆਪਣੀ ਜ਼ਿੰਦਗੀ ਦੇ ਵਿੱਚ ਖਿੜਦੇ ਹਨ ਉਸੇ ਤਰ੍ਹਾਂ ਮੈਂ ਵੀ ਇਨ ਫਿਊਚਰ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਕੇ ਖਿੜਾਂ